ਪਾਸਤਾ ਪੀਜਾ ਮਕਰੋਨੀ ਕੜੀ ਚਾਵਲ ਰਾਜਮਾ ਚਾਵਲ ਸਾਗ ਮੱਕੀ ਦੀ ਰੋਟੀ ਦਾਲ ਪਨੀਰ ਸ਼ਾਹੀ ਕੜਾਈ ਮਟਰ ਪਨੀਰ ਮਸ਼ਰੂਮ ਮਟਰ ਆਲੂ ਗੋਭੀ